ਟੀ ਵੀ ਉੱਤੇ ਔਨਲਾਈਨ ਅਤੇ ਵਧੇਰੇ ਮੁਫਤ ਵਧੀਆਤ ਸਮੱਗਰੀ ਜਿਹੜੀ ਹੈਗੀ ਆ ਉਹ ਉਪਲੱਬਧ ਕਰਵਾਉਣੀ ਚਾਹੀਦੀ ਆ ਕਿਉਂਕਿ ਹੁਣ ਆਪਾਂ ਪਲੇਅ ਸਟੋੋਰ ਤੋਂ ਜੇਕਰ ਬੱਚੇ ਐਪ ਭਰਦੇ ਆ ਪੜ੍ਹਨ ਵਾਸਤੇ ਉਹ ਜਿੰਨੀਆਂ ਐਪਸ ਮੋਸਟਲੀ ਜਿਹੜੀਆਂ ਐਪਸ ਹੁੰਦੀਆਂ ਵਾ ਉਹ ਪੈਸੇ ਮੰਗਦੀਆਂ ਵਾ ਅਤੇ ਇੱਦਾਂ ਸਗੋਂ ਜੇ ਟੀ ਵੀ ਉੱਪਰ ਚੈਨਲ ਹੋਣਗੇ ਅਤੇ ਫਿਰ ਬੱਚਿਆਂ ਨੂੰ ਪੜ੍ਹਨ ਵਿੱਚ ਆਸਾਨੀ ਹੋਊਗੀ ਕਈਆਂ ਬੱਚਿਆਂ ਜਿਹੜੇ ਮਾਪੇ ਹੁੰਦੇ ਆ ਉਹ ਇੰਨੇ ਚਾਰਜਿਸ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਤਾਂ ਸਗੋਂ ਚੰਗਾ ਇਹ ਵਧੀਆ ਰਹੂਗਾ ਕਿ ਟੀ ਵੀ ਉੱਤੇ ਫਰੀ ਦੇ ਵਿੱਚ ਹੀ ਕੋਈ ਨਾ ਕੋਈ ਹੋਵੇ ਚੈਨਲ ਜਿਹਦੇ ਜਿਹਦੇ ਉੱਤੇ ਬੱਚੇ ਪੜ੍ਹ ਸਕਣ ਜਿਦਾਂ ਕਿ ਫਿਜਿਕਸ ਦਾ ਚੈਨਲ ਹੋ ਗਿਆ ਕਮਿਸਟਰੀ ਮੈਥ ਬਾਇਓ ਇਹ ਜੇ ਸਬਜੈਕਟ ਆ ਇਹ ਬੜੇ ਔਖੇ ਆ ਅਤੇ ਬੜੇ ਜ਼ਰੂਰੀ ਆ ਅਤੇ ਇਹਨਾਂ ਦੇ ਚੈਨਲ ਹੋਣ ਬੱਚਿਆਂ ਵਾਸਤੇ ਤਾਂ ਜੋ ਬੱਚਿਆਂ ਨੂੰ ਆਪਣੀ ਪੜ੍ਹਾਈ ਵਿੱਚ ਸਹਾਇਤਾ ਮਿਲ ਸਕੇ ਕਈ ਜਿਹੜੇ ਮਾਂ ਪਿਓ ਹੁੰਦੇ ਆ ਉਹ ਬੱਚਿਆਂ ਨੂੰ ਟਵੀਸ਼ਨ ਵੀ ਨਹੀਂ ਰਖਵਾ ਪਾਉਂਦੇ ਹੈਗੇ ਅਤੇ ਫਿਰ ਇਹਨਾਂ ਚੈਨਲਾਂ ਦੀ ਮਦਦ ਨਾਲ ਮਦਦ ਦੇ ਨਾਲ ਹੀ ਜਿਹੜੇ ਬੱਚੇ ਆ ਉਹ ਪੜ੍ਹ ਸਕਦੇ ਆ ਵਧੀਆ ਟਵੀਸ਼ਨ ਇੱਥੋਂ ਵੀ ਪੜ੍ਹ ਹੀ ਸਕਦੇ ਆ ਬੱਚੇ ਅਤੇ ਜਿਹੜੀਆਂ ਐਪਸ ਹੁੰਦੀਆਂ ਵਾ ਉਹ ਬੜੀਆਂ ਮਹਿੰਗੀਆਂ ਵਾ ਬੜੇ ਪੈਸੇ ਚਾਰਜ ਕਰਦੇ ਆ ਜਿੱਦਾਂ ਕਿ ਬਾਏਜੂਸ ਹੋ ਗਿਆ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਐਪਾਂ ਹੈਗੀਆਂ ਵਾ ਜਿਹੜੀਆਂ ਕਿ ਪੈਸੇ ਲੈਂਦੀਆਂ ਵਾ ਅਤੇ ਸਗੋਂ ਇੱਦਾਂ ਟੀ ਵੀ ਉੱਤੇ ਆਵੇ ਪ੍ਰੋਗਰਾਮ ਜੇ ਫਰੀ 'ਚ ਹੋਵੇ ਸਗੋਂ ਤਾਂ ਬੱਚੇ ਵਧੀਆ ਸਿੱਖ ਸਕਦੇ ਆ ਜਿੱਦਾਂ ਕਿ ਹੁਣ ਛੋਟੇ ਬੱਚੇ ਹੋ ਗਏ ਉਹਨਾਂ ਨੂੰ ਹੁਣ ਸਿਖਾਇਆ ਕੋਈ ਕਾਟੂਨ ਵਰਕ ਕੋਈ ਕਾਟੂਨ ਜਿਹੇ ਬਣਾ ਦੇਣ ਟੀ ਵੀ ਵਾਲੇ ਕਿ ਉਹ 'ਤੇ ਦੱਸਿਆ ਹੋਵੇ ਕਿ ਪਹਿਲਾਂ ਲਾਈਨ 'ਚ ਲੱਗਣਾ ਕੋਈ ਵੀ ਫੂਡ ਲੈਣਾ ਵਾ ਜਾਂ ਬੋਲਣਾ ਕਿਸ ਤਰ੍ਹਾਂ ਵਾ ਕਈ ਚੈਨਲ ਇੰਗਲਿਸ਼ ਵੀ ਸਿਖਾਉਂਦੇ ਆ ਮਤਲਬ ਕਿ ਇਹ ਬੱਚਿਆਂ ਲਈ ਬਹੁਤ ਜ਼ਰੂਰੀ ਆ ਅਤੇ ਇਹਨਾਂ ਦੀ ਜਿਹੜੀ ਪਾਲਣਾ ਵਾ ਉਹ ਹੋਣੀ ਚਾਹੀਦੀ ਆ